ਪੋਲਟਰੀ ਫਾਰਮਿੰਗ ਵਿੱਚ ਪੋਲਟਰੀ ਦੀ ਚੰਗੀ ਤਰ੍ਹਾਂ ਦੇਖਭਾਲ ਕਰਨ ਅਤੇ ਉਹਨਾਂ ਨਾਲ ਦੁਰਵਿਵਹਾਰ ਨਾ ਕਰਨ ਲਈ ਕਈ ਤਰੀਕੇ ਅਪਣਾਏ ਜਾ ਸਕਦੇ ਹਨ ਉਹਨਾਂ ਵਿੱਚ ਕੁਝ ਤਰੀਕੇ ਹਨ ਪਹਿਲਾ ਖੁੱਲ੍ਹੀ ਅਤੇ ਸਭ ਸਾਂਭ ਵਾਲੀ ਥਾਂ ਮੁਰਗੀਆਂ ਨੂੰ ਤੰਗ ਜਗ੍ਹਾ ਵਿੱਚ ਰੱਖਣ ਦੀ ਬਜਾਏ ਉਹਨਾਂ ਨੂੰ ਖੁੱਲ੍ਹੀ ਥਾਂ ਦਿਓ ਤਾਂ ਜੋ ਉਹ ਆਜ਼ਾਦੀ ਨਾਲ ਘੁੰਮ ਸਕਣ ਦੂਸਰਾ ਪੋਸ਼ਟਿਕ ਆਹਾਰ ਉਹਨਾਂ ਨੂੰ ਉਮਰ ਅਤੇ ਤੰਦਰੁਸਤੀ ਅਨੁਸਾਰ ਪੂਰੀ ਪੌਸ਼ਟਿਕਤਾ ਵਾਲਾ ਖਾਣਾ ਦਿਓ ਤੀਸਰਾ ਕੁਦਰਤੀ ਵਿਕਾਸ ਲਈ ਮੋਕਾ ਦਿਓ ਕੁਦਰਤੀ ਢੰਗ ਨਾਲ ਉਹਨਾਂ ਨੂੰ ਵਿਕਸਿਤ ਹੋਣ ਦਿਓ ਚੌਥਾ ਚੰਗੀ ਤਬੀਅਤ ਅਤੇ ਦਵਾਈਆਂ ਦੀ ਜਾਂਚ ਨਿਯਮਿਤ ਤਬੀਅਤ ਦੀ ਜਾਂਚ ਕਰਵਾਉਣੀ ਚਾਹੀਦੀ ਹੈ ਤਾਂ ਜੋ ਬਿਮਾਰੀਆਂ ਤੋਂ ਬਚਿਆ ਜਾ ਸਕੇ ਮੁਰਗੀਆਂ ਨਾਲ ਨਰਮੀ ਨਾਲ ਵਿਵਹਾਰ ਉਹਨਾਂ ਨੂੰ ਮਾਰਪੀਟ ਜਾਂ ਦਬਾਉ ਦੇ ਤਰੀਕੇ ਨਾਲ ਨਹੀਂ ਪਕੜਨਾ ਚਾਹੀਦਾ ਹਿਮਸਾਥੀ ਪੋਲਟਰੀ ਫਾਰਮਿੰਗ ਅਪਣਾਓ ਉਹਨਾਂ ਦੀ ਕੁਦਰਤੀ ਜ਼ਿੰਦਗੀ ਨੂੰ ਨਸ਼ਟ ਨਾ ਕਰਕੇ ਉਹਨਾਂ ਨੂੰ ਆਜ਼ਾਦੀ ਨਾਲ ਰਹਿਣ ਦੀ ਇਜਾਜ਼ਤ ਦਿਓ